ਮੇਰੀਆਂ ਮੇਰੀ ਬਹੁਤ ਸਾਰੀਆਂ ਸਹੇਲੀਆਂ ਹਨ ਜਿਸਨੇ ਡਿਗਰੀਆਂ ਕੀਤੀਆਂ ਹੈ ਕੋਲੇਜ ਦੇ ਵਿੱਚ ਰਹਿ ਕੇ ਪਰ ਮੈਂ ਅੱਜ ਆਪਣੀ ਸਹੇਲੀ ਰਮਨਦੀਪ ਕੌਰ ਦੀ ਗੱਲ ਕਰਨਾ ਚਾਹਵਾਂਗੀ ਰਮਨਦੀਪ ਕੌਰ ਨੇ ਆਪਣੀ ਬਾਰ੍ਹਾਂ ਪਾਸ ਕਰਨ ਤੋਂ ਬਾਅਦ ਬੀਐੱਸਸੀ ਐਗਰੀਕਲਚਰ ਦੀ ਡਿਗਰੀ ਕੀਤੀ ਕੇਸੀ ਕੋਲੇਜ ਤੋਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅੰਡਰ ਬੀਐੱਸਸੀ 'ਚ ਚਾਰ ਸਾਲ ਲਗਾ ਕੇ ਫਿਰ ਉਹਨਾਂ ਨੇ ਐੱਮਐੱਸਸੀ ਡਿਗਰੀ ਕਰਨ ਦੀ ਸਲਾਹ ਬਣਾਈ ਉਹਨਾਂ ਨੇ ਐੱਮਐੱਸਸੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਤੋਂ ਕੀਤੀ ਐੱਮਐੱਸਸੀ ਕਰਨ ਤੋਂ ਬਾਅਦ ਉਹਨਾਂ ਨੇ ਹੋਰ ਵੀ ਜ਼ਿਆਦਾ ਪੜ੍ਹਾਈ ਦੇ ਵਿੱਚ ਰੁਚੀ ਹੋਣ ਕਰਕੇ ਨੈੱਟ ਕੋਆਲੀਫਾਈ ਕੀਤਾ ਫਿਰ ਪੜ੍ਹਾਈ ਦੇ ਵਿੱਚ ਦਿਲਚਸਪੀ ਜ਼ਿਆਦਾ ਹੋਣ ਕਰਕੇ ਨੈੱਟ ਤੋਂ ਬਾਅਦ ਉਹਨਾਂ ਨੇ ਜੇ ਆਰਐੱਫਵੀ ਕੋਆਲੀਫਾਈ ਕੀਤਾ ਜਿਸ ਕਾਰਨ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਕੋਲਰਸ਼ਿਪ ਦਿੱਤੀ ਗਈ ਹੁਣ ਉਹ ਉਸ ਸਕੋਲਰਸ਼ਿਪ ਦੀ ਮਦਦ ਦੇ ਨਾਲ਼ ਪੀਐੱਚਡੀ ਕਰਨ ਜਾ ਰਹੀ ਹੈ ਮੈਨੂੰ ਆਪਣੀ ਸਹੇਲੀ ਰਮਨਦੀਪ ਕੌਰ 'ਤੇ ਬਹੁਤ ਮਾਣ ਹੈ ਉਹ ਲੜਕੀ ਪੜ੍ਹਾਈ ਦੇ ਵਿੱਚ ਬਹੁਤ ਰੁਚੀ ਰੱਖਦੀ ਹੈ ਅਤੇ ਮੇਰੇ ਲਈ ਵੀ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੇਰੀ ਸਹੇਲੀ ਪੀਐੱਚਡੀ ਕਰਨ ਜਾ ਰਹੀ ਹੈ ਪੀਐੱਚਡੀ ਦੇ ਨਾਲ਼ ਨਾਲ਼ ਉਹ ਜੋਬ ਵੀ ਕਰਦੀ ਹੈ ਜੋਬ ਦੇ ਲਈ ਉਹਨੂੰ ਵੱਖ ਵੱਖ ਸੰਸਥਾਵਾਂ ਵੱਲੋਂ ਔਫਰਸ ਆਏ ਸੀ ਪਰ ਹੁਣ ਉਹ ਇਸ ਟਾਈਮ ਕੇਸੀ ਕੋਲੇਜ ਦੇ ਵਿੱਚ ਹੀ ਜੋਬ ਕਰ ਰਹੀ ਹੈ ਕੇਸੀ ਕੋਲੇਜ ਦੇ ਵਿੱਚ ਉਹ ਐਜ ਅਸਿਸਟੈਂਟ ਪ੍ਰੋਫੈਸਰ ਦੀ ਭੂਮਿਕਾ ਨਿਭਾ ਰਹੀ ਹੈ ਅਤੇ ਬੱਚਿਆਂ ਨੂੰ ਚੰਗੀ ਸ਼ਿਕਸ਼ਾ ਦੇ ਰਹੀ ਹੈ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਇਲਾਕੇ ਦੇ ਵਿੱਚ ਲੜਕੀਆਂ ਪੜ੍ਹ ਲਿਖ ਕੇ ਕਾਫ਼ੀ ਅੱਗੇ ਜਾਂਦੀਆਂ ਹਨ ਅਤੇ ਪੜ੍ਹਾਈ ਦੇ ਵਿੱਚ ਕਾਫ਼ੀ ਰੁਚੀ ਰੱਖਦੀਆਂ ਹਨ ਅਤੇ ਪੀਐੱਚਡੀ ਲੈਵਲ ਤੱਕ ਪੜ੍ਹਾਈ ਕਰਦੀਆਂ ਹਨ